ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਤਾਨੀਆ ਬੋਲ ਰਹੇ ਹੋ ਹਾਂਜੀ ਮੈਂ ਨਾ ਤੁਹਾਡੇ ਕੋਲੋਂ ਮੈਂ ਸੁਣਿਆ ਵਾ ਕਿ ਤੁਸੀਂ ਜਿਹੜੀ ਉਹ ਬੀਜਾਂ ਬਾਰੇ ਰਿਸਰਚ ਕਰ ਰਹੇ ਹੋ ਮੈਮ ਮੈਂ ਤੁਹਾਡੇ ਕੋਲੋਂ ਨਾ ਹਾੜੀ ਸਾਉਣੀ ਦੀਆਂ ਫ਼ਸਲਾਂ ਦੇ ਬੀਜ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਹਾਂ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਅ ਰਹੀ ਸੀ ਜਿੱਦਾਂ ਬੀਜਾਂ ਦੇ ਜਿਹੜੇ ਪਹਿਲਾਂ ਰੇਟ ਸੀਗੇ ਉਹ ਜਿੰਨੇ ਰੇਟ ਸੀ ਉਸੇ ਰੇਟ 'ਤੇ ਸਾਨੂੰ ਮਿਲਣ ਜਾ ਰਹੀਆਂ ਕਿ ਜਾਂ ਫਿਰ ਇਹਨਾਂ ਦੇ ਰੇਟਸ ਵਿੱਚ ਵੀ ਫ਼ਰਕ ਹੋਵੇਗਾ ਠੀਕ ਆ ਮੈਮ ਤੁਸੀਂ ਮੈਨੂੰ ਫਿਜ਼ੀਕਲੀ ਮਿਲ ਸਕਦੇ ਹੋ ਆਪਣਾ ਕੰਟੈਕਟ ਨੰਬਰ ਹਾਂਜੀ ਹਾਂਜੀ ਠੀਕ ਆ ਮੈਂ ਤੁਹਾਨੂੰ ਇਹ ਆਪਣੀ ਲੋਕੇਸ਼ਨ ਵ੍ਹਟਸਐਪ ਰਾਹੀਂ ਸੈਂਡ ਕਰ ਦਾਂਗੀ ਅਤੇ ਤੁਸੀਂ ਮੈਨੂੰ ਮਿਲ ਲਿਓ ਫਿਰ ਥੈਂਕ ਯੂ ਓਕੇ ਬਾਏ